ਸਿਲਾਈ ਦਾ ਕੰਮ ਕਰਨ ਲਈ ਬਹੁਤ ਮਿਹਨਤ ਹੁੰਦੀ ਹੈ ਇਹਦੇ ਵਿੱਚ ਅਸੀਂ ਰੰਗਾਂ ਨੂੰ ਕਈ ਤਰ੍ਹਾ ਨਾਲ ਚੁਣ ਸਕਦੇ ਹਾਂ ਜਿਵੇਂ ਲਾਲ ਰੰਗ ਨਾਲ ਕਾਲੇ ਨੂੰ ਚੁਣ ਲਿਆ ਕਾਲੇ ਨਾਲ ਨੀਲੇ ਨੂੰ ਹਰੇ ਨੂੰ ਚੁਣ ਲਿਆ ਮਤਲਬ ਉਹ ਗੋਲਡਨ ਕਲਰ ਦਾ ਇਹਦੇ ਸਭ ਤੋਂ ਵੱਡਾ ਮਹੱਤਵਪੂਰਨ ਰਹਿੰਦਾ ਹੈ ਵੀ ਅਸੀਂ ਹਰ ਸ਼ੇਡ ਨਾਲ ਮਿਲਾ ਸਕਦੇ ਹਾਂ ਕਈ ਰੰਗਾਂ ਨੂੰ ਲੈ ਕੇ ਕਈ ਕਲਰ ਆਉਂਦੇ ਆ ਅਸੀਂ ਰੰਗਾ ਨੂੰ ਵੇਖ ਕੇ ਸੂਟਾਂ ਦੇ ਰੰਗਾਂ ਵਿੱਚੋਂ ਰੰਗ ਨੂੰ ਹੀ ਮੈਚ ਕਰ ਲੈਂਦੇ ਹਾਂ ਜਿਵੇਂ ਕਾਲੇ ਅਤੇ ਗੁਲਾਬੀ ਫਲਾਵਰ ਆ ਗਿਆ ਤਾਂ ਗੁਲਾਬੀ ਰੰਗ ਦਾ ਹੀ ਸ਼ੇਡ ਨਿਕਾਲਤਾ ਉਹਦਾ ਕੱਢ ਲੈਂਦੇ ਹਾਂ ਪਲੇਟਾਂ ਲਈ ਇਹੀ ਕਿਹਾ ਜਾ ਸਕਦਾ ਕਿ ਸਰੀਰ ਦੀ ਬਣਾਵਟ ਦੇ ਅਨੁਸਾਰ ਪਲੇਟ ਲਈ ਜਾਂਦੀ ਹੈ ਕੋਈ ਜਿਵੇਂ ਮੋਟਾ ਹੋ ਗਿਆ ਤਾਂ ਉਹਦੇ ਵਾਸਤੇ ਵੱਡੀ ਪਲੇਟ ਲੈ ਲਈ ਜੋ ਪਤਲਾ ਹੈ ਉਹਦੇ ਵਾਸਤੇ ਘੱਟ ਪਲੇਟ ਲੈ ਲਈ ਗੈਪ ਘੱਟ ਰੱਖ ਲਿਆ ਕਾਫੀ ਪਲੇਟਾਂ ਦਾ ਵੀ ਮਹੱਤਵਪੂਰਨ ਰਹਿੰਦਾ ਸੂਟ ਨੂੰ ਤਿਆਰ ਕਰਨ 'ਚ ਰੰਗਾਂ ਵਾਸਤੇ ਇਹੀ ਹੈ ਕਿ ਰੰਗ ਕਿਸੇ ਨਾਲ ਕਿਸੇ ਨੂੰ ਵੀ ਚੁਣਿਆ ਜਾ ਸਕਦਾ ਕੋਈ ਰੰਗ ਕਿਵੇਂ ਜੱਚ ਜਾਂਦਾ ਕੋਈ ਕਿਵੇਂ ਜੱਚ ਜਾਂਦਾ ਮੇਰਾ ਆਪਦਾ ਫੇਵਰੇਟ ਕਲਰ ਮਹੱਤਵ ਮਨਪਸੰਦ ਰੰਗ ਜਿਹੜੇ ਨੇ ਉਹ ਨੇ ਲਾਲ ਕਾਲਾ ਨੀਲਾ ਪੀਲਾ ਵੀ ਕਲਰ ਅੱਛਾ ਚੱਲਦਾ ਰੰਗਾਂ ਦੇ ਵਿੱਚੋਂ ਪੀਲੇ ਦੇ ਨਾਲ ਜਿਵੇਂ ਹੁਣ ਕਾਲੇ ਦਾ ਕੰਟਰਾਸਟ ਬਹੁਤ ਵਧੀਆ ਰਹਿੰਦਾ ਪਲੇਟਾਂ ਦੀ ਬਨਾਵਟ ਵੀ ਬਹੁਤ ਅੱਛੀ ਲੱਗਦੀ ਹੈ ਪਲੇਟ ਬਿਨਾਂ ਸੂਟ ਦੀ ਫਿਟਿੰਗ ਨਹੀਂ ਆਉਂਦੀ ਪਲੇਟ ਪਾਉਣ ਨਾਲ ਸੂਟ ਦੀ ਫਿਟਿੰਗ ਬਹੁਤ ਪਿਆਰੀ ਆ ਜਾਂਦੀ ਹੈ